ਹਾਂਜੀ ਘੁੰਮਣ ਫਿਰਨ ਦਾ ਬਹੁਤ ਪਸੰਦ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਘੁੰਮਣ ਫਿਰਨ ਦੇ ਤਾਂ ਅਸੀਂ ਐਨੇ ਸ਼ਕੀਨ ਹੈ ਮਨ ਕਰਦਾ ਈ ਰਹਿੰਦਾ ਕਦੇ ਕੀਤੇ ਚਲੇ ਜਾਈਏ ਦੂਰ ਦੂਰ ਜਗ੍ਹਾ 'ਤੇ ਦਿਲ ਕਰਦਾ ਹੈ ਜਾਣ ਦਾ ਘੁੰਮਣ ਦਾ ਬਾਹਰ ਦੇ ਨਜ਼ਾਰੇ ਦੇਖਣ ਦਾ ਜਿੱਥੇ ਦੇਖ ਕੇ ਮੀਨਜ਼ ਆਪਾਂ ਨੂੰ ਬਹੁਤ ਹੀ ਜ਼ਿਆਦਾ ਉਹ ਅੱਗੇ ਸਿੱਖਿਆ ਵੀ ਮਿਲਦੀ ਹੈ ਨੌਲੇਜ ਮਿਲਦੀ ਆ ਪਤਾ ਲੱਗਦਾ ਬਾਹਰ ਜਿੱਥੇ ਵੀ ਆਪਾਂ ਜਾਂਦੇ ਹਾਂ ਠੀਕ ਹੈ ਜ਼ਿਆਦਾ ਮੀਨਜ਼ ਮੈਨੂੰ ਇੱਦਾਂ ਲੱਗਦਾ ਵੀ ਮੈਨੂੰ ਤਾਂ ਪਹਾੜੀ ਏਰੀਆ 'ਚ ਜਾਣ ਦਾ ਮੇਰਾ ਬਹੁਤ ਮਨ ਕਰਦਾ ਹਰਿਆਲੀ ਜਿੱਥੇ ਵਧੀਆ ਮੀਨਜ਼ ਮਾਹੌਲ ਹੋਵੇ ਇਨਵਾਇਰਮੈਂਟ ਵਧੀਆ ਹੋਵੇ ਪਾਣੀ ਜਿੱਦਾਂ ਠੀਕ ਹੈ ਦੂਰ ਇੱਦਾਂ ਝਰਨਿਆ 'ਚ ਜਿੱਥੇ ਜਾ ਕੇ ਸਕੂਨ ਮਿਲਦਾ ਇਨਸਾਨ ਨੂੰ ਠੀਕ ਹੈ ਉਹ ਦਿਮਾਗ ਫਰੈਸ਼ ਹੋ ਜਾਂਦਾ ਅਤੇ ਮਜ਼ਾ ਆਉਂਦਾ ਸ਼ਪੈਸਲੀ ਮਤਲਵ ਤੁਹਾਡੀ ਸਾਰਾ ਸਟਰੈਸ ਖਤਮ ਹੋ ਜਾਂਦਾ ਹੈ ਘੁੰਮ ਫਿਰ ਕੇ ਠੀਕ ਹੈ ਜਾਣਾ ਵੀ ਜ਼ਰੂਰੀ ਹੈ ਇਨਵਾਇਰਮੈਂਟ ਚੇਂਜ ਹੁੰਦਾ ਠੀਕ ਹੈ ਅਤੇ ਤੁਹਾਨੂੰ ਵਧੀਆ ਲੱਗਦਾ ਥੋੜ੍ਹਾ ਦਿਮਾਗ ਵੀ ਫਰੈੱਸ਼ ਹੁੰਦਾ ਅਤੇ ਸਭ ਨੂੰ ਜਾਣ